ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਜਸਲੀਨ ਘਰ ਤੋਂ ਬੋਲਦੇ ਪਏ ਹੋ ਹਾਂਜੀ ਮੈਂ ਨਾ ਤੁਹਾਡੇ ਨਾਲ ਸਕੂਲ ਦੇ ਬਾਰੇ ਕੁਛ ਡਿਸਕਸ਼ਨ ਕਰਨਾ ਚਾਹੁੰਦੀ ਸੀ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਪਾਉਣਾ ਹੈ ਅਤੇ ਕਿਹੜਾ ਸਕੂਲ ਉੱਥੇ ਬੈਸਟ ਆ ਆਪਾਂ ਕਿਹੜੇ ਸਕੂਲ ਬੱਚੇ ਨੂੰ ਪਾਈਏ ਹਾਂਜੀ ਠੀਕ ਆ ਜੀ ਮੈਂ ਫਿਰ ਉੱਥੇ ਹੀ ਆਪਣੇ ਬੱਚਿਆਂ ਨੂੰ ਪਾਵਾਂਗੀ ਮੇਰੇ ਸ਼ਾਮੀ ਘਰਵਾਲਾ ਆਉਂਦਾ ਹੈ ਤਾਂ ਮੈਂ ਉਹਦੇ ਨਾਲ ਸਲਾਹ ਕਰਕੇ ਅਤੇ ਆਪਣੇ ਬੱਚਿਆਂ ਦਾ ਸਵੇਰੇ ਹੀ ਉੱਥੇ ਦਾਖਲਾ ਕਰਵਾ ਕੇ ਜਾਂਦੀ ਹਾਂ ਅਤੇ ਤੁਸੀਂ ਵੀ ਆ ਜਾਣਾ ਠੀਕ ਆ ਧੰਨਵਾਦ ਠੀਕ ਹੈ ਜੀ ਧੰਨਵਾਦ